ਹਾਂਜੀ ਮੈਂ ਤੁਹਾਨੂੰ ਕੀ ਦੱਸਾਂ ਅਸੀਂ ਇੱਕ ਦਿਨ ਘਰ ਸਾਗ ਬਣਾਇਆ ਅਤੇ ਮੀਨਜ਼ ਵੈਸੇ ਸਾਡੇ ਅਕਸਰ ਸਾਗ ਬਣਦਾ ਹੀ ਰਹਿੰਦਾ ਜਦੋਂ ਵੀ ਕੋਈ ਆਉਂਦਾ ਮੱਕੀ ਦਾ ਰੋਟੀ ਸਾਗ ਅਸੀਂ ਬਣਾਉਂਦੇ ਹੀ ਰਹਿੰਦੇ ਹੈਂ ਦਿਨ ਮੇਂ ਸਾਗ ਬਣਾਇਆ ਤਾਂ ਮੈਂ ਜਿੱਦਾਂ ਆਪਾਂ ਸਾਗ ਬਣਾਉਂਦੇ ਹਾਂ ਸਾਗ ਧਰਤਾ ਮੈਂ ਧਰ ਕੇ ਉਹਦੇ ਵਿੱਚ ਨਮਕ ਪਾ ਦਿੱਤਾ ਪਹਿਲਾਂ ਜਦੋਂ ਆਪਾਂ ਬਣਾਉਂਦੇ ਠੀਕ ਹੈ ਜਦੋਂ ਬਣ ਗਿਆ ਤਾਂ ਮੇਰੇ ਧਿਆਨ 'ਚ ਸਕਿਪ ਕਰ ਗਿਆ ਮੇਰੀ ਸ ਫਰੈਂਡ ਦਾ ਫੋਨ ਆ ਗਿਆ ਮੇਰੇ ਉਹਦੇ ਨਾਲ ਗੱਲਾਂ ਕਰਨ 'ਚ ਰੁੱਝ ਗਈ ਜਦੋਂ ਸਾਗ ਬਣਿਆ ਦੁਬਾਰਾ ਫੇਰ ਮੈਨੂੰ ਜਦੋਂ ਮੈਂ ਤੜਕਾ ਲਗਾਉਣ ਲੱਗੀ ਮੇਰੇ ਦਿਮਾਗ 'ਚ ਨਿਕਲ ਗਿਆ ਵੀ ਮੈਂ ਉਹਦੇ ਵਿੱਚ ਨਮਕ ਪਾਇਆ ਹੋਇਆ ਹੈ ਠੀਕ ਹੈ ਦੁਬਾਰਾ ਪਾਉਣਾ ਨਹੀਂ ਮੈਂ ਫਿਰ ਉਹਦੇ ਵਿੱਚ ਨਮਕ ਪਾ ਦਿੱਤਾ ਅਤੇ ਜਦੋਂ ਖਾਣ ਲੱਗੇ ਉਹ ਇੰਨਾ ਤੇਜ਼ ਹੋ ਗਿਆ ਫਿਰ ਮੈਨੂੰ ਇੱਦਾਂ ਲੱਗਿਆ ਜਾਂ ਤਾਂ ਹੁਣ ਕੰਮ ਖਰਾਬ ਹੋ ਗਿਆ ਫੇਰ ਮੇਰੇ ਯਾਦ ਆਇਆ ਵੀ ਆਪਾਂ ਜਦੋਂ ਨਮਕ ਜ਼ਿਆਦਾ ਹੋ ਜਾਂਦਾ ਹੈ ਠੀਕ ਹੈ ਤਾਂ ਫਿਰ ਆਪਾਂ ਆਟੇ ਦੀ ਗੁਥਲੀ ਆ ਜਿਹੜੀ ਉਹ ਬਣਾ ਕੇ ਆਟਾ ਗੂੰਨੇ ਹੋਏ ਆਟੇ ਦੀ ਗੁਥਲੀ ਬਣਾ ਕੇ ਆਪਾਂ ਉਹਦੇ ਵਿੱਚ ਸਿੱਟ ਦਿੰਦੇ ਹਾਂ ਠੀਕ ਹੈ ਉਹ ਥੋੜ੍ਹੀ ਦੇਰ ਰੱਖਦੇ ਹਾਂ ਉਹਦੇ ਨਾਲ ਨਮਕ ਸਾਰਾ ਚੂਸਿਆ ਜਾਂਦਾ ਹੈ ਉਹਦਾ ਫਲੇਵਰ ਸੈੱਟ ਹੋ ਜਾਂਦਾ ਠੀਕ ਹੈ ਤਾਂ ਮੈਂ ਉੱਦਾਂ ਹੀ ਨਮਕ ਦੀ ਗੁੱਠੀ ਬਣਾ ਕੇ ਸਾਗ ਦੇ ਵਿੱਚ ਸਿੱਟੀ ਅਤੇ ਨਮਕ ਦਾ ਟੇਸਟ ਆ ਜਿਹੜਾ ਉਹਦਾ ਬਹੁਤ ਫਰਕ ਮੀਨਜ਼ ਉਹ ਪੈ ਗਿਆ ਠੀਕ ਹੈ ਫਿਰ ਮੈਂ ਟੇਸਟ ਕਰਕੇ ਵੇਖਿਆ ਵੀ ਠੀਕ ਹੈ ਫਿਰ ਮੈਨੂੰ ਪਤਾ ਲੱਗਿਆ ਵੀ ਹਾਂ ਸ਼ੁਕਰ ਹੈ ਚਲੋ ਇੱਦਾਂ ਦੀਆਂ ਘਰੇਲੂ ਚੀਜ਼ਾਂ ਕੁਛ ਬੰਦੇ ਨੂੰ ਆਉਣੀਆ ਚਾਹੀਦੀਆਂ ਜਿਸ ਦੇ ਨਾਲ ਆਪਾਂ ਜੇ ਕੋਈ ਆਪਣੇ ਤੋਂ ਇੱਦਾਂ ਦੀ ਕੁਛ ਹੋ ਜਾਏ ਤਾਂ ਆਪਾਂ ਨੂੰ ਠੀਕ ਕਰ ਸਕੀਏ ਠੀਕ ਹੈ ਔਰ ਸਾਗ ਤਾਂ ਤੁਹਾਨੂੰ ਪਤਾ ਹੀ ਹੈ ਮੀਨਸ ਇੰਨਾ ਵਧੀਆ ਹੈ ਸਭ ਦਾ ਹੀ ਪਸੰਦ ਦੀ ਰੈਸਪੀ ਹੈ ਠੀਕ ਹੈ ਸਾਰੇ ਜ਼ਿਆਦਾਤਰ ਜੋ ਵੀ ਹੈ ਸ਼ਕੀਨ ਹੈ ਦੁਨੀਆ ਸਰਦੀ ਦੇ ਵਿੱਚ ਸਾਗ ਖਾਂਦੀ ਹੈ ਮੱਕੀ ਦੀ ਰੋਟੀ ਖਾਂਦੀ ਨਾਲ ਬਹੁਤ ਹੀ ਵਧੀਆ ਲੱਗਦਾ ਸਰਦੀ 'ਚ ਵਧੀਆ ਡਿਸ਼ ਹੈ ਇਹ ਸਿਹਤ ਵਾਸਤੇ ਵਧੀਆ ਠੀਕ ਹੈ ਸਭ ਤੋਂ ਵੱਡੀ ਗੱਲ ਬਹੁਤ ਹੀ ਇਹਦਾ ਇਹ ਹੈ ਵੀ ਜਦੋਂ ਬਣਾ ਕੇ ਰੱਖ ਦਿੰਦੇ ਹੈ ਤਾਂ ਦੋ ਤਿੰਨ ਦਿਨ ਵੀ ਚਲ ਜਾਂਦਾ ਠੀਕ ਹੈ ਬਹੁਤ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਇਹਦੇ 'ਚ ਇਹ ਵੀ ਕਹਿ ਦਿੰਦੇ ਸਾਗ ਜਿੰਨਾਂ ਪੁਰਾਣਾ ਖਾਉ ਉੱਨਾਂ ਹੀ ਜ਼ਿਆਦਾ ਵਧੀਆ ਹੈ ਘਰ ਦੀ ਖੇਤੀ ਹੁੰਦੀ ਹੈ ਠੀਕ ਹੈ ਆਪਣੀ ਬਹੁਤ ਹੀ ਵਧੀਆ ਮੀਨਜ਼ ਲੱਗਦਾ ਹੈ ਜਦੋਂ ਖਾਂਦੇ ਹਾਂ ਮੱਕੀ ਦੀ ਰੋਟੀ ਫਿਰ ਨਜ਼ਾਰਾ ਆ ਜਾਂਦਾ ਆਏਂ ਲੱਗਦਾ ਵੀ ਆਹਾ ਹਾ ਪੰਜਾਬ ਦੀ ਸੈਰ ਕਰ ਲਈ ਹੈ ਸਾਗ ਖਾ ਕੇ ਤਾਂ ਠੀਕ ਹੈ ਮੱਕੀ ਦੀ ਰੋਟੀ ਖਾ ਕੇ ਤਾਂ ਇਹ ਤਾਂ ਆਪਣੀਆਂ ਘਰ ਦੀਆਂ ਇਕ ਉਹ ਹੈਗ ਇਹ ਚੀਜ਼ ਬਹੁਤ ਵਧੀਆ ਹੈ ਮੀਨਸ ਵੀ ਚਲੋ ਮੈਂ ਕਹਿੰਦੀ ਹਾਂ ਰੈਸਪੀ ਜਦੋਂ ਤੁਸੀਂ ਕੁਛ ਖਾਣਾ ਬਣਾਉਂਦੇ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਵੀ ਜਦੋਂ ਤੁਹਾਦੇ ਤੋਂ ਕੁਛ ਹੋ ਜੇ ਤਾਂ ਉਹਨੂੰ ਤੁਸੀਂ ਸੈੱਟ ਕਿਵੇਂ ਕਰ ਸਕਦੇ ਓਂ ਠੀਕ ਹੈ ਤਾਂ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਵੀ ਉਹਨਾਂ ਦੀਆਂ ਬਣੀਆਂ ਹੋਈਆਂ ਜੋ ਹੈਗੀਆਂ ਉਵੇਂ ਅੱਜ ਵੀ ਆਪਣੇ ਕੰਮ ਆ ਰਹੀਆਂ ਹਨ ਹਾਂਜੀ